ਨਮਸਕਾਰ ਮੇਰਾ ਨਾਮ ਪੂਜਾ ਦੇਵੀ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਸਾਡੇ ਇੱਥੇ ਪਠਾਨਕੋਟ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਹਨ ਘੁੰਮਣ ਫਿਰਨ ਨੂੰ ਦੀਆਂ ਜੋ ਕਿ ਸੈਲਾਨੀ ਇੱਥੇ ਘੁੰਮਣ ਫਿਰਨ ਆਉਂਦੇ ਹਨ ਸਾਡੇ ਇੱਥੇ ਮਹਾਰਾਜਾ ਰਣਜੀਤ ਸਿੰਘ ਡੈਮ ਇੱਥੇ ਲੋਕ ਡੈਮ ਦੇਖਣ ਜਾਂਦੇ ਹਨ ਜੇ ਅਸੀਂ ਗੱਲ ਕਰੀਏ ਜੁਗਿਆਲ ਦੀ ਇੱਥੇ ਬਹੁਤ ਪੁਰਾਣਾ ਸ਼ਿਵਜੀ ਦਾ ਮੰਦਰ ਹੈ ਜਿੱਥੇ ਵੀ ਕਈ ਲੋਕ ਸ਼ਿਵਰਾਤਰੀ ਦੇਖਣ ਆਉਂਦੇ ਹਨ ਜੋ ਕਿ ਮੁਕੇਸਰਾ ਵੱਲ ਹੈ ਮੁਕੇਸਰਾ ਤੋਂ ਇਲਾਵਾ ਨਾਲ ਹੀ ਇੱਕ ਮਿਨੀ ਗੋਆ ਪਾਰਕ ਵੀ ਹੈ ਇੱਥੇ ਬਹੁਤ ਹੀ ਸੋਹਣੀ ਸਾਈਡ ਹੈ ਜੋ ਕਿ ਲੋਕ ਬੜੀ ਦੂਰ ਦੂਰ ਤੋਂ ਆਉਂਦੇ ਹਨ ਇਸ ਤੋਂ ਇਲਾਵਾ ਪਠਾਨਕੋਟ ਦੇ ਵਿੱਚ ਖਾਣ ਪੀਣ ਦੀਆਂ ਬਹੁਤ ਸਾਰੀਆਂ ਜਗ੍ਹਾ ਹਨ ਸਾਡੇ ਇੱਥੇ ਇੱਥੇ ਇੱਕ ਬਹੁਤ ਵੱਡਾ ਵੇਵ ਮਾਲ ਵੀ ਹੈ ਮੋਲ ਵੀ ਹੈ ਇੱਥੇ ਬਹੁਤ ਬਹੁਤ ਸਾਰੇ ਸ਼ੋਪਿੰਗ ਕਰਨ ਲਈ ਆਉਂਦੇ ਹਨ ਸਾਡੇ ਪਠਾਨਕੋਟ ਦੇ ਵਿੱਚ ਹੋਰ ਵੀ ਸੈਰ ਸਪਾਟੇ ਵਾਸਤੇ ਬਹੁਤ ਬਹੁਤ ਹੀ ਜਗ੍ਹਾ ਹਨ ਜੋ ਕਿ ਲੋਕ ਦੂਰੋਂ ਦੂਰੋਂ ਦੇਖਣ ਲਈ ਆਉਂਦੇ ਹਨ ਧੰਨਵਾਦ